ਮੈਂ ਆਪਣੀ ਪ੍ਰਾਇਮਰੀ ਸਿੱਖਿਆ ਸ਼ੁਰੂ ਕੀਤੀ ਸੀ ਸੰਤ ਨਾਮਦੇਵ ਪਬਲਿਕ ਸਕੂਲ ਤੋਂ ਜੋ ਕਿ ਇੱਕ ਪ੍ਰਾਈਵੇਟ ਸਕੂਲ ਸੀ ਇਹ ਸਕੂਲ ਸਾਡੇ ਨਵੇਂ ਗਰਾਂਓ ਜਿੱਥੇ ਮੈਂ ਰਹਿੰਦਾ ਹਾਂ ਉੱਥੇ ਸਥਿਤ ਹੈ ਇੱਥੇ ਬਹੁਤ ਜ਼ਿਆਦਾ ਕੁਸ਼ਲ ਟੀਚਰਾਂ ਸੀਗੀਆਂ ਜੋ ਕਿ ਸਾਨੂੰ ਬਹੁਤ ਹੀ ਪਿਆਰ ਅਤੇ ਬਹੁਤ ਹੀ ਤਰੀਕੇ ਨਾਲ ਪੜ੍ਹਾਉਂਦੀਆਂ ਸੀਗੀਆਂ ਜਿਹੜੀ ਚੀਜ਼ ਨਹੀਂ ਆਉਂਦੀ ਸੀਗੀ ਉਹ ਸਾਨੂੰ ਸਭ ਸਿਖਾਉਂਦੀਆਂ ਸੀਗੀਆਂ ਜਿੱਥੇ ਸਾਡੀ ਗ਼ਲਤੀ ਹੁੰਦੀ ਸੀਗੀ ਉੱਥੇ ਸਾਨੂੰ ਡਾਂਟ ਦੀਆਂ ਵੀ ਸੀਗੀਆਂ ਪਰ ਸ ਉਹ ਇਹੀ ਚਾਹੁੰਦੀ ਸੀਗੀਆਂ ਕਿ ਅਸੀਂ ਜ਼ਿੰਦਗੀ 'ਚ ਕਿਤੇ ਅੱਗੇ ਵਧੀਏ ਕਿਉਂਕਿ ਬੱਚੇ ਬਚਪਨ ਵਿੱਚ ਬਹੁਤ ਨਾ ਸਮਝੀਆਂ ਹੁੰਦੀਆਂ ਹਨ ਜੇ ਇਹਨਾਂ ਨੇ ਸਾਨੂੰ ਸਾਡੀ ਉਸ ਨਾ ਸਮਝੀਆਂ ਨੂੰ ਸਹੀ ਕਰਵਾਇਆ ਹੈ ਉਸ ਉਸ ਸੰਤ ਨਾਮ ਸਕੂਲ ਵਿੱਚ ਮੈਂ ਪੰਜਵੀਂ ਤੱਕ ਆਪਣੀ ਸਿੱਖਿਆ ਕੀਤੀ ਹੈ ਜਿਸ ਵਿੱਚ ਮੈਨੂੰ ਮੇਰੇ ਵਿੱਚ ਬਹੁਤ ਸੁਧਾਰ ਮਿਲਿਆ ਮੇਰੀ ਰਾਈਟਿੰਗ ਵਿੱਚ ਬਹੁਤ ਸੁਧਾਰ ਹੋਇਆ ਅਤੇ ਮੈਂ ਸਿੱਖਦੇ ਸਿੱਖਦੇ ਮੈਨੂੰ ਬਹੁਤ ਕੁਛ ਸਿਖਾਇਆ ਗਿਆ ਜਿਸ ਵਿੱਚ ਮੈਂ ਇੰਨਾ ਜ਼ਿਆਦਾ ਉਹ ਹੋ ਗਿਆ ਕਿ ਹਰ ਨੋਰਮਲ ਚੀਜ਼ਾਂ ਨੂੰ ਮੈਂ ਕਰ ਸਕਦਾ ਸੀ ਸਮਝ ਸਕਦਾ ਸੀ ਮੈਡਮਾਂ ਨੇ ਸਾਨੂੰ ਮੈਥ ਹਿੰਦੀ ਹਰੇਕ ਤਰ੍ਹਾਂ ਦੀ ਸਿੱਖਿਆ ਦਿੱਤੀ ਅਤੇ ਕੋਈ ਵੀ ਇਹੋ ਜਿਹਾ ਸਬਜੈਕਟ ਨਹੀਂ ਛੱਡਿਆ ਕਿ ਜਿਸ ਵਿੱਚ ਸਾਡੀ ਕੋਈ ਕਮੀ ਰਹੀ ਹੋਵੇ ਇੰਗਲਿਸ਼ ਤੋਂ ਲੈ ਕੇ ਹਿੰਦੀ ਤੋਂ ਲੈ ਕੇ ਹਰੇਕ ਸਾਡੀ ਮਾਂ ਬੋਲੀ ਤੋਂ ਲੈ ਕੇ ਹਰੇਕ ਭਾਸ਼ਾਵਾਂ ਦਾ ਸਾਨੂੰ ਗਿਆਨ ਦਿੱਤਾ ਗਿਆ ਉਸ ਤੋਂ ਬਾਅਦ ਮੈਂ ਆਪਣੇ ਪੰਜਵੀਂ ਦੇ ਪੇਪਰ ਸਰਕਾਰੀ ਸਕੂਲ ਨਵਾਂ ਗਰਾਉਂ ਵਿੱਚ ਦਿੱਤੇ ਜੋ ਕਿ ਸਾਡੇ ਲਈ ਇੱਕ ਬਹੁਤ ਹੀ ਨਵੀਂ ਜਗ੍ਹਾ ਸੀ ਪਰ ਕਿਸੇ ਕਾਰਨਾਂ ਕਰਕੇ ਥੋੜ੍ਹੀ ਘਬਰਾਹਟ ਵੀ ਹੁੰਦੀ ਸੀ ਪਰ ਪੜ੍ਹਾਈ ਜਦੋਂ ਅਸੀਂ ਕੀਤੀ ਹੋਈ ਸੀ ਤਾਂ ਸਾਨੂੰ ਉਸਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਇਹਨਾਂ ਚੀਜ਼ਾਂ ਤੋਂ ਬਾਅਦ ਮੈਂ ਸਰਕਾਰੀ ਸਕੂਲ ਨਵਾਂ ਗਰਾਉਂ ਵਿੱਚ ਛੇਵੀਂ ਕਲਾਸ ਵਿੱਚ ਦਾਖਲਾ ਲਿਆ ਜਿੱਥੇ ਦਾ ਮਾਹੌਲ ਬਹੁਤ ਹੀ ਜ਼ਿਆਦਾ ਪੜ੍ਹਾਈ ਵਾਲਾ ਸੀ ਉੱਥੇ ਦੇ ਹੈੱਡ ਮਿਸਟਰੈਸ ਮਿਸਿਜ਼ ਬੰਦਨਾ ਕੁਮਾਰੀ ਸੀ ਜੋ ਕਿ ਇੱਕ ਬਹੁਤ ਹੀ ਅਨੁਸ਼ਾਸਨ ਪਸੰਦ ਔਰਤ ਸੀ ਉਹ ਹਰੇਕ ਬੱਚੇ ਨੂੰ ਅਨੁਸ਼ਾਸਨ ਵਿੱਚ ਰੱਖਦੇ ਸਨ ਅਤੇ ਹਰੇਕ ਤਰ੍ਹਾਂ ਦੀ ਕੋਸ਼ਿਸ਼ ਕਰਦੇ ਸਨ ਕਿ ਉਹਨਾਂ ਦਾ ਸਕੂਲ ਪਹਿਲੇ ਨੰਬਰ 'ਤੇ ਬਣਿਆ ਰਹੇ ਉੱਥੇ ਸਾਨੂੰ ਬਹੁਤ ਹੀ ਅੱਛੇ ਟੀਚਰ ਮਿਲੇ ਜੋ ਕਿ ਸਾਨੂੰ ਸਾਡੀ ਫੈਮਿਲੀ ਵਾਂਗ ਹੀ ਰੱਖਦੇ ਸਨ ਹਰੇਕ ਤਰ੍ਹਾਂ ਦਾ ਪੜ੍ਹਾਇਆ ਜਾਂਦਾ ਸੀ ਹਰੇਕ ਗੱਲ ਸਮਝਾਈ ਜਾਂਦੀ ਸੀ ਉਸ ਤੋਂ ਇਲਾਵਾ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਗਈ ਅਤੇ ਸਾਡੇ ਕੰਪਿਊਟਰ ਦੇ ਸਰ ਜਿਹਨਾਂ ਨੇ ਸਾਨੂੰ ਕੰਪਿਊਟਰ ਵਿੱਚ ਬਹੁਤ ਹੀ ਜ਼ਿਆਦਾ ਤਰ੍ਹਾਂ ਦੀਆਂ ਐਪਲੀਕੇਸ਼ਨ ਸਿਖਾਈ ਬਹੁਤ ਹੀ ਤਰ੍ਹਾਂ ਦੀ ਕੋਡਿੰਗ ਸਿਖਾਈ ਅਤੇ ਉਸ ਤੋਂ ਇਲਾਵਾ ਲੈਂਗੂਏਜਾਂ ਦਾ ਗਿਆਨ ਦਿੱਤਾ ਕਿ ਕੰਪਿਊਟਰ ਵਿੱਚ ਪੰਜਾਬੀ ਟਾਈਪਿੰਗ ਕਿਵੇਂ ਕੀਤੀ ਜਾਂਦੀ ਹੈ ਜੋ ਕਿ ਪੰਜਾਬੀ ਸਕੂਲ ਵਿੱਚ ਬਹੁਤ ਜ਼ਿਆਦਾ ਲਾਭਵੰਦ ਹੁੰਦੀ ਹੈ ਇਸ ਤੋਂ ਬਾਅਦ ਉੱਥੇ ਪੜ੍ਹਦੇ ਪੜ੍ਹਦੇ ਮੇਰੇ ਬਹੁਤ ਸਾਰੇ ਦੋਸਤ ਬਣੇ ਜਿਨ੍ਹਾਂ ਨੇ ਮੈਨੂੰ ਮੇਰੀ ਪੜ੍ਹਾਈ ਵਿੱਚ ਵੀ ਸਾਥ ਦਿੱਤਾ ਹੋਰ ਚੀਜ਼ਾਂ ਵਿੱਚ ਵੀ ਸਾਥ ਦਿੱਤਾ ਅਸੀਂ ਇੱਕ ਫੈਮਿਲੀ ਦੀ ਤਰ੍ਹਾਂ ਬਣੇ ਹੋਏ ਸੀ ਅਤੇ ਜਦੋਂ ਇਹੋ ਜਿਹੇ ਦੋਸਤ ਹੋਣ ਤਾਂ ਪੜ੍ਹਾਈ ਵਿੱਚ ਵੀ ਬੰਦੇ ਦਾ ਮਨ ਲੱਗਿਆ ਰਹਿੰਦਾ ਹੈ ਅਤੇ ਸਕੂਲ ਵਿੱਚ ਹੀ ਸਾਨੂੰ ਖੇਡਣ ਲਈ ਵੀ ਜਾਂ ਖੇਡਾਂ ਵਿੱਚ ਪ੍ਰਭਾਵਿਤ ਕੀਤਾ ਜਾਂਦਾ ਸੀ ਕਿਉਂਕਿ ਕਹਿੰਦੇ ਹਨ ਕਿ ਤੰਦਰੁਸਤ ਦਿਮਾਗ ਹੀ ਅਸਲੀ ਪੜ੍ਹਾਈ ਕਰ ਸਕਦਾ ਹੈ ਅਤੇ ਤੰਦਰੁਸਤ ਦਿਮਾਗ ਹੋਣ ਲਈ ਸਰੀਰ ਵੀ ਤੰਦਰੁਸਤ ਚਾਹੀਦਾ ਹੈ ਇਸ ਤਰ੍ਹਾਂ ਮੈਂ ਉੱਥੋਂ ਆਪਣੀ ਛੇਵੀਂ ਕਲਾਸ ਸੱਤਵੀਂ ਕਲਾਸ ਕਰਦੇ ਕਰਦੇ ਆਪਣੀ ਦਸਵੀਂ ਕਲਾਸ ਤੱਕ ਆਇਆ ਅਤੇ ਇਹਨਾਂ ਸਾਲਾਂ ਵਿੱਚ ਮੈਂ ਬਹੁਤ ਹੀ ਜ਼ਿਆਦਾ ਸਿੱਖਿਆ ਕਿ ਅਧਿਆਪਕਾਂ ਨਾਲ ਕਿਵੇਂ ਦਾ ਵਰਤਾਉ ਕਰਨਾ ਚਾਹੀਦਾ ਹੈ ਜਾਂ ਆਪਣੀ ਪੜ੍ਹਾਈ ਨੂੰ ਜੋ ਸਾਨੂੰ ਨਹੀਂ ਆਉਂਦਾ ਅਸੀਂ ਉਸਨੂੰ ਦੁਬਾਰਾ ਦੁਬਾਰਾ ਪੁੱਛ ਕੇ ਕਿਵੇਂ ਠੀਕ ਕਰ ਸਕਦੇ ਹਾਂ ਜਾਂ ਜੋ ਟੀਚਰ ਸਾਨੂੰ ਪੜ੍ਹਾ ਰਿਹਾ ਹੈ ਅਸੀਂ ਉਸਦਾ ਹਮੇਸ਼ਾ ਸਨਮਾਨ ਕਰਨਾ ਹੈ ਕਿਉਂਕਿ ਗੁਰੂ ਹੁੰਦਾ ਹੈ ਉਹ ਜੋ ਸਾਨੂੰ ਹਰੇਕ ਚੀਜ਼ ਸਿਖਾਉਂਦਾ ਹੈ ਅਤੇ ਸਾਡੇ ਸਾਨੂੰ ਕਦੇ ਵੀ ਗੁੱਸਾ ਨਹੀਂ ਕਰਦਾ ਉਸ ਤੋਂ ਬਾਅਦ ਮੈਂ ਆਪਣੀ ਗਿਆਰਵੀਂ ਦੀ ਸਿੱਖਿਆ ਸਰਕਾਰੀ ਸਕੂਲ ਸੈਕਟਰ ਤੇਈ ਚੰਡੀਗੜ੍ਹ ਤੋਂ ਕੀਤੀ ਇੱਥੇ ਜਾਂਦੇ ਜਾਂਦੇ ਮੇਰੇ ਸਕੂਲ ਦਾ ਮੀਡੀਅਮ ਵੀ ਚੇਂਜ ਹੋ ਗਿਆ ਸੀ ਜੋ ਕਿ ਪੰਜਾਬੀ ਤੋਂ ਬਦਲ ਕੇ ਇੰਗਲਿਸ਼ ਹੋ ਗਿਆ ਸੀ ਉਸ ਸਕੂਲ ਵਿੱਚ ਮੈਂ ਬਹੁਤ ਹੀ ਟਾਈਮ ਬਾਅਦ ਚੇਂਜ ਹੋਣ ਕਾਰਨ ਮੈਨੂੰ ਬਹੁਤ ਹੀ ਜ਼ਿਆਦਾ ਅਸਹਿਜ ਲੱਗ ਰਿਹਾ ਸੀ ਜਿਸ ਕਾਰਨ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਇਕਦਮ ਮੇਰਾ ਮਾਹੌਲ ਚੇਂਜ ਹੋਇਆ ਵਾ ਹੋਵੇ ਇਸ ਤਰ੍ਹਾਂ ਕਰਨ ਨਾਲ਼ ਪਹਿਲੇ ਪਹਿਲੇ ਤਾਂ ਮੇਰਾ ਉੱਥੇ ਮਨ ਨਹੀਂ ਲੱਗਿਆ ਕੋਈ ਵੀ ਮੈਨੂੰ ਜਾਣਦਾ ਨਹੀਂ ਸੀ ਉੱਪਰੋਂ ਮੇਰਾ ਸਬਜੈਕਟ ਆਟਸ ਤੋਂ ਚੇਂਜ ਹੋ ਕੇ ਨੋਨ ਮੈਡੀਕਲ ਹੋ ਗਿਆ ਸੀ ਆਟਸ ਤੋਂ ਚੇਂਜ ਹੋਣ ਤੋਂ ਬਾਅਦ ਇਕਦਮ ਮੈਡੀਕਲ ਹੋਣ ਕਾਰਨ ਮੈਨੂੰ ਉੱਥੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਟਿਊਸ਼ਨਾਂ ਤੋਂ ਬਿਨਾ ਮੈਨੂੰ ਹਰੇਕ ਚੀਜ਼ ਸਮਝ ਨਹੀਂ ਆਉਂਦੀ ਸੀ ਕੁਝ ਆਸਾਨ ਚੀਜ਼ਾਂ ਸੀ ਜੋ ਮੈਨੂੰ ਸਮਝ ਆਉਂਦੀਆਂ ਸੀ ਪਰ ਜਿਹੜੀ ਮੁਸ਼ਕਲ ਚੀਜ਼ਾਂ ਸੀ ਮੈਂ ਉਹਨਾਂ ਵੱਲ ਧਿਆਨ ਨਹੀਂ ਦੇ ਪਾਉਂਦਾ ਸੀ ਅਤੇ ਇਸ ਤਰ੍ਹਾਂ ਕਰਦੇ ਕਰਦੇ ਮੈਨੂੰ ਉੱਥੇ ਬਹੁਤ ਜ਼ਿਆਦਾ ਗੈਪ ਮਹਿਸੂਸ ਹੋਇਆ ਮੈਂ ਇਹੀ ਚਾਹਿਆ ਕਿ ਮੈਂ ਉਹ ਸਭ ਚੀਜ਼ਾਂ ਨੂੰ ਸਮਝ ਸਕਾਂ ਪਰ ਕਿਸੀ ਕਾਰਨ ਕਰਕੇ ਉਹ ਚੀਜ਼ਾਂ ਮੇਰੇ ਤੋਂ ਦੂਰ ਜਾਂਦੀਆਂ ਰਹੀਆਂ ਮੈਂ ਹਿੰਮਤ ਨਹੀਂ ਹਾਰੀ ਪਰ ਫਿਰ ਉਸ ਚੀਜ਼ ਨੂੰ ਮੈਂ ਦੁਬਾਰਾ ਇੱਕ ਵਾਰ ਕਰਿਆ ਅਤੇ ਦੁਬਾਰਾ ਦੁਬਾਰਾ ਕਰਨ ਨਾਲ ਉਨ੍ਹਾਂ ਚੀਜ਼ਾਂ ਨੇ ਮੈਨੂੰ ਇਹ ਸਿਖਾਇਆ ਕਿ ਦੁਬਾਰਾ ਦੁਬਾਰਾ ਕੋਸ਼ਿਸ਼ ਕਰਨ ਨਾਲ ਸਾਰੀ ਚੀਜ਼ਾਂ ਸਮਝ ਆ ਸਕਦੀਆਂ ਹਨ ਇਸ ਤਰ੍ਹਾਂ ਇਹ ਚੀਜ਼ਾਂ ਕਰਦੇ ਕਰਦੇ ਮੈਂ ਉਨ੍ਹਾਂ ਚੀਜ਼ਾਂ ਵਿੱਚ ਵੀ ਕਾਮਯਾਬ ਹੋਇਆ ਅਤੇ ਮੈਂ ਆਪਣੀ ਪੜ੍ਹਾਈ ਬਹੁਤ ਹੀ ਅੱਛੀ ਤਰ੍ਹਾਂ ਬਾਰਵੀਂ ਪੂਰੀ ਕੀਤੀ ਉਸ ਤੋਂ ਬਾਅਦ ਮੈਂ ਸਰਕਾਰੀ ਆਈ ਟੀ ਆਈ ਸੈਕਟਰ ਅਠਾਈ ਵਿੱਚ ਦਾਖਲਾ ਲਿਆ ਉੱਥੇ ਮੈਂ ਆਪਣਾ ਇੱਕ ਮੁੱਖ ਵਿਸ਼ੇ ਨੂੰ ਜਿਸ 'ਚ ਮੇਰਾ ਇੰਟਰਸਟ ਸੀ ਕੰਪਿਊਟਰ ਵਿਸ਼ੇ ਨੂੰ ਚੁਣਿਆ ਅਤੇ ਉੱਥੇ ਮੈਂ ਐਡਵਾਂਸ ਕੋਡਿੰਗ ਅਤੇ ਹੋਰ ਕਈ ਤਰ੍ਹਾਂ ਦੇ ਮਾਈਕਰੋਸੋਫਟ ਪ੍ਰੋਜੈਕਟਾਂ ਬਾਰੇ ਸਿੱਖਿਆ ਇਸ ਤੋਂ ਇਲਾਵਾ ਟਾਈਪਿੰਗ ਟੈਲੀ ਇਹ ਸਭ ਸਿਖਾਇਆ ਗਿਆ ਉੱਥੇ ਦਾ ਨੇਚਰ ਵੀ ਬਹੁਤ ਵਧੀਆ ਸੀ ਟੀਚਰਾਂ ਦਾ